ਮੇਰਾ ਮਨ ਪਸੰਦ ਮੌਸਮ ਸਰਦੀਆਂ ਹੈ ਕਿਉਂਕਿ ਇਹ ਮੌਸਮ ਮੈਨੂੰ ਸਭ ਤੋਂ ਵਧੀਆ ਚੰਗਾ ਲੱਗਦਾ ਹੈ ਲੇਕਿਨ ਧੁੱਪ ਵੀ ਬੜੀ ਪਿਆਰੀ ਲੱਗਦੀ ਹੈ ਤੇ ਗਰਮੀਆਂ ਦੇ ਵਿੱਚ ਕੱਪੜੇ ਰੋਜ਼ ਬਦਲਣੇ ਪੈਂਦੇ ਹੈ ਅਤੇ ਬਦਬੂ ਫੈਲਣੇ ਦਾ ਵੀ ਡਰ ਰਹਿੰਦਾ ਹੈ ਕੱਪੜਿਆਂ ਚ ਇਸ ਕਰਕੇ ਮੈਨੂੰ ਸਰਦੀਆਂ ਦਾ ਮੌਸਮ ਜ਼ਿਆਦਾ ਪਸੰਦ ਹੈ